ਪੰਜਾਬ ਵਿੱਚ ਬਹੁਤ ਸਾਰੇ ਵੱਡੇ ਵੱਡੇ ਥੀਏਟਰ ਸਿਨੇਮਾਜ਼ ਹਨ ਜੋ ਕਿ ਬਹੁਤ ਹੀ ਜ਼ਿਆਦਾ ਫਿਲਮਾਂ ਹਰ ਹਫਤੇ ਲੱਗੀਆਂ ਹੀ ਰਹਿੰਦੀਆਂ ਨੇ ਕਦੇ ਨਹੀਂ ਬੰਦ ਹੁੰਦੀਆਂ ਕਦੇ ਵੀ ਹਰ ਫਰਾਈਡੇ ਨਵੀਂ ਫਿਲਮ ਆ ਜਾਂਦੀ ਆ ਅਤੇ ਸਾਰੇ ਸਿਨੇਮਾ ਪੈਸੇ ਕਮਾਉਣ ਨੂੰ ਬੈਠੇ ਆ ਸਾਰੇ ਟਿਕਟ ਦੀਆਂ ਕੀਮਤਾਂ ਟਾਈਮ ਟਾਈਮ ਦੇ ਹਿਸਾਬ ਨਾਲ ਬਦਲਦੀਆਂ ਰਹਿੰਦੀਆਂ ਨੇ ਅਤੇ ਸਾਡੇ ਇੱਥੇ ਖੰਨੇ ਵਿੱਚ ਪੀ ਵੀ ਆਰ ਸਿਨੇਮਾ ਸੈਲੀਬ੍ਰੇਸ਼ਨ ਮੋਲ ਆਦਰਸ਼ ਬਹੁਤ ਸਾਰੇ ਮੋਲ ਨੇ ਅਤੇ ਮੋਹਾ ਖਰੜ ਪੀ ਵੀ ਆਰ ਮੋਲ ਇਹ ਪੀ ਵੀ ਆਰ ਵਿੱਚ ਕੀਮਤਾਂ ਦਾ ਰੇਟ ਖਰੜ ਵਾਲੀਆਂ ਵਿੱਚ ਥੋੜ੍ਹਾ ਮਹਿੰਗਾ ਏ ਅਤੇ ਖੰਨੇ ਵਾਲੀਆਂ 'ਚ ਸਸਤਾ ਏ ਅਗਰ ਹਾਊਸਫੁੱਲ ਹੋ ਜਾਂਦਾ ਏ ਤਾਂ ਕੀਮਤਾਂ ਦਾ ਰੇਟ ਵੀ ਉਸ ਹਿਸਾਬ ਨਾਲ ਵਧਾ ਦਿੱਤਾ ਜਾਂਦਾ ਏ ਟਿਕਟਾਂ ਦਾ ਰੇਟ ਵੀ ਉਸ ਹਿਸਾਬ ਨਾਲ ਵਧਾ ਦਿੱਤਾ ਜਾਂਦਾ ਏ ਇਹ ਸਾਡਾ ਖੁਦ ਦਾ ਕੀਤਾ ਹੋਇਆ ਐਕਸਪੀਰੀਅੰਸ ਆ ਅਤੇ ਹੋਰ ਸਹੂਲਤਾਂ ਵੀ ਬਹੁਤ ਨੇ ਜਿਵੇਂ ਗਰਮੀਆਂ ਵਿੱਚ ਏ ਸੀ ਵੀ ਲੱਗੇ ਹੋਏ ਨੇ